ਪੰਜਾਬ ਦੇ ਪਿੰਡ ਵਿੱਚ ਜ਼ਮੀਨ ਦੀ ਮਾਲਕੀ ਨਾਲ ਸੰਬੰਧਿਤ ਵਿਵਾਦਾਂ ਨੂੰ ਹੱਲ ਕਰਨ ਦੇ ਲਈ ਕਾਫ਼ੀ ਕਾਫ਼ੀ ਜ਼ਿਆਦਾ ਕਾਨੂੰਨ ਜਿਹੜੇ ਹੈ ਉਹ ਅਵੇਲੇਬਲ ਹੈ ਅਤੇ ਅਗਰ ਇੱਦਾਂ ਦਾ ਕੋਈ ਵਿਵਾਦ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਅੱਛੇ ਵਕੀਲ ਨੂੰ ਮਿਲੋ ਉਹਦੇ ਕੋਲ ਵਕੀਲ ਨੂੰ ਤੋਂ ਜਾਣ ਵਕੀਲ ਕੋਲ ਜਾਣ ਤੋਂ ਪਹਿਲਾਂ ਆਪਣੇ ਸਾਰੇ ਜਿਹੜੇ ਵੀ ਡੋਕੂਮੈਂਟ ਤੁਹਾਡੇ ਹੈਗੇ ਹੈ ਜਿਵੇਂ ਤੁਹਾਡੇ ਘਰ ਦੀ ਰਜਿਸਟਰੀ ਹੋ ਗਈ ਇੰਤਕਾਲ ਹੋ ਗਿਆ ਬਿਆਨਾ ਹੋ ਗਿਆ ਜਾਂ ਜਿੰਨੀ ਵੀ ਤੁਹਾਡੀ ਪੈਲੀ ਦੀ ਹੈ ਜਾਂ ਕੁਛ ਵੀ ਹੈ ਉਹ ਸਾਰਾ ਕੁਛ ਤੁਸੀਂ ਆਪਣਾ ਲੈ ਕੇ ਵਕੀਲ ਕੋਲ ਜਾਓ ਫਿਰ ਉਹਨੂੰ ਦੱਸੋ ਕਿ ਵਈ ਇੱਦਾਂ ਇੱਦਾਂ ਆਹ ਗੱਲ ਹੈ ਇਹ ਸਾਡੀ ਜ਼ਮੀਨ ਹੈ ਚਾਹੇ ਉਹ ਤੁਹਾਡੀ ਜ਼ਮੀਨ ਕਿਸੇ ਨੇ ਮੱਲ ਲਈ ਹੈ ਜਾਂ ਕਿਸੇ ਨੇ ਧੱਕੇ ਨਾਲ ਆਪਣੇ ਨਾਮ ਕਰਵਾ ਲਈ ਹੈ ਅਤੇ ਉਹਦੀ ਅਥਾਰਟੀ ਤੁਹਾਡੇ ਕੋਲ ਹੈ ਜਾਂ ਤੁਸੀਂ ਕਿਸੇ ਦੀ ਮੱਲੀ ਹੈ ਜਾਂ ਕੁਛ ਵੀ ਹੈ ਜਿਵੇਂ ਦਾ ਵੀ ਤੁਹਾਡਾ ਜੋ ਵੀ ਹੈਗਾ ਸਾਰਾ ਕੁਛ ਵਕੀਲ ਨੂੰ ਦੱਸੋ ਫਿਰ ਉਹਨੂੰ ਪੁੱਛੋ ਕਿ ਹਾਂ ਪੀ ਇਹਦਾ ਕੀ ਹੱਲ ਹੋ ਸਕਦਾ ਹੈ ਜੇ ਤੁਹਾਡੀ ਜ਼ਮੀਨ ਕਿਸੇ ਨੇ ਗਲਤ ਧੱਕੇ ਨਾਲ ਮੱਲ ਲਈ ਹੈ ਤਾਂ ਤੁਸੀਂ ਉਹ ਕੋਲੋਂ ਛਡਾਉਣ ਲਈ ਕੀ ਕਰ ਸਕਦੇ ਹੋ ਪਹਿਲਾਂ ਵਕੀਲ ਕੋਲੋਂ ਇਸ ਚੀਜ਼ ਦੀ ਸਲਾਹ ਲਓ ਜਦੋਂ ਵਕੀਲ ਕੋਲੋਂ ਸਲਾਹ ਲੈਂਦੇ ਹੋ ਉਸ ਤੋਂ ਬਾਅਦ ਤੁਸੀਂ ਇੱਕ ਐੱਫ ਆਈ ਆਰ ਜਿਹੜੀ ਹੈ ਉਹ ਲਗਾਓ ਦਾਇਰ ਕਰੋ ਦੂਸਰੇ ਪਾਰਟੀ 'ਤੇ ਕਿ ਹਾਂ ਪੀ ਇਹ ਬੰਦੇ ਨੇ ਇੱਦਾਂ ਇੱਦਾਂ ਕਰਕੇ ਮੇਰੀ ਜਿਹੜੀ ਜ਼ਮੀਨ ਹੈ ਉਹ ਲੈ ਲਈ ਹੈ ਉਹਨਾਂ 'ਤੇ ਐੱਫ ਆਈ ਆਰ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਕੋਰਟ ਦੇ ਵਿੱਚ ਕੇਸ ਚੱਲੇਗਾ ਕੋਰਟ ਦੇ ਵਿੱਚ ਕੇਸ ਚੱਲਣ ਤੋਂ ਬਾਅਦ ਉਨ੍ਹਾਂ ਦੂਜੀ ਪਾਰਟੀ ਵਾਲਿਆਂ ਨੂੰ ਬੁਲਾਇਆ ਜਾਏਗਾ ਉਨ੍ਹਾਂ ਦੀ ਵੀ ਰਾਇ ਲਈ ਜਾਏਗੀ ਔਰ ਫਿਰ ਜੋ ਅਦਾਲਤ ਫੈਸਲਾ ਕਰੇਗੀ ਉਹਦੇ ਅਕੋਡਿੰਗ ਫਿਰ ਸਾਰਾ ਕੁਛ ਚੱਲੇਗਾ ਅੱਗੇ ਥੈਂਕਿ ਊ